ਭੰਗੜਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਸਾਡੇ ਪੰਜਾਬ ਦਾ ਜਿਹੜਾ ਕਿ ਜਨਾਨੀਆਂ ਜਿਹੜੀਆਂ ਨੇ ਇਸ ਨੂੰ ਕਮੀਜ਼ ਸਲਵਾਰ ਪਾਉਂਦੀਆਂ ਨੇ ਅਤੇ ਨਾਲ ਨਾਲ ਕੇਸ ਪਰਾਂਦਾ ਪਾਂਉਦੀਆਂ ਹਨ ਅਤੇ ਪੰਜਾਬੀ ਜੁੱਤੀ ਪਾਉਂਦੀਆਂ ਹਨ ਅਤੇ ਪੇ ਹੱਥਾਂ ਵਿੱਚ ਗੋਰਖਰੂ ਪਾਉਂਦੀਆਂ ਹਨ ਅਤੇ ਆਪਣੇ ਗਲੇ ਵਿੱਚ ਹਾਰ ਲਟਕਾਉਂਦੀਆਂ ਨੇ ਅਤੇ ਮੂ ਮੁੰਡੇ ਜਿਹੜੇ ਨੇ ਉਹ ਆਪਣੇ ਧੋਤੀ ਅਤੇ ਕੁੜਤਾ ਪਾਂਉਦੇ ਨੇ ਅਤੇ ਵੱਡਾ ਵੱਡਾ ਕੈਂਠਾ ਪਾ ਕੇ ਅਤੇ ਨਾਲ ਇੱਕ ਰੁਮਾਲ ਰੱਖਦੇ ਹਨ ਅਤੇ ਬਹੁਤ ਵਧੀਆ ਸਾਰਾ ਦਾ ਵਧੀਆ ਸਾਰਾ ਨਾਚ ਨੱਚਦੇ ਨੇ ਜਿਹੜਾ ਕਿ ਸਭ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਬਹੁਤ ਸ ਬਹੁਤ ਇਹ ਬਹੁਤ ਹੁੰਦੇ ਕਸਰਤ ਦਾ ਵੀ ਇੱਕ ਤਰੀਕਾ ਹੈ ਬਹੁਤ ਵਧੀਆ ਤਰੀਕਾ ਹੈ ਜਿਹੜਾ ਕਿ ਇਹ ਖੁਸ਼ ਹੋਣ ਦਾ ਵੀ ਪੰਜਾਬ ਦੇ ਸਾਰੇ ਲੋਕ ਇਹਨੂੰ ਬੜਾ ਪਸੰਦ ਕਰਦੇ ਨੇ ਸਾਰੇ ਬੱਚੇ ਬੁੱਢੇ ਸਭ ਇਸਦੇ ਇਸ ਦੇ ਪਹਿਰਾਵੇ ਨੂੰ ਬਹੁਤ ਪਸੰਦ ਕਰਦੇ ਨੇ ਉਹ ਵੀ ਇਹ ਹੀ ਪਾ ਕੇ ਡਾਂਸ ਡਾਂਸ ਕਰਦੇ ਨੇ ਨੱਚਦੇ ਨੇ ਨੱਚਦੇ ਟੱਪਦੇ ਨੇ ਅਤੇ ਨੱਚ ਟੱਪ ਕੇ ਆਪਣੀ ਖੁਸ਼ੀਆਂ ਨੂੰ ਜਾਹਰ ਕਰਦੇ ਨੇ ਜੇ ਕੋਈ ਵੀ ਤਿਉਹਾਰ ਆਉਂਦਾ ਹੈ ਅਤੇ ਲੋਕ ਭੰਗੜਾ ਪਾਉਂਦੇ ਨੇ ਅਤੇ ਭੰਗੜੇ ਭੰਗੜੇ ਵਿੱਚ ਹੀ ਲੋਕ ਰੁੱਝ ਜਾਂਦੇ ਨੇ ਅਤੇ ਫਿਰ ਉਸਨੂੰ ਖੁਸ਼ੀਆਂ ਮਾਣਦੇ ਨੇ ਅਤੇ ਫਿਰ ਆਪਣੇ ਉਹ ਰੂ ਆਪਣੀ ਉਹ ਆਪਣੀ ਬਣਾ ਲੈਂਦੇ ਨੇ ਆਪਣੀ ਖੂਬੀ ਬਣਾ ਲੈਂਦੇ ਨੇ ਕਿ ਅਸੀਂ ਭੰਗੜਾ ਹੀ ਪਾਉਣਾ ਭੰਗੜੇ ਦੀ ਬਹੁਤ ਹੀ ਮੈਂ ਬਹੁਤ ਹੀ ਜ਼ਿਆਦਾ ਵਡਿਆਈ ਇਸ ਪੰਜਾਬ ਵਿੱਚ ਦੱਸੀ ਗਈ ਹੈ ਭੰਗੜੇ ਬਗੈਰ ਕੋਈ ਵੀ ਕੋਈ ਵੀ ਕੋਈ ਜਿਹੜਾ ਹੁੰਦਾ ਹੈ ਕੋਈ ਵੀ ਫੰਕਸ਼ਨ ਕੋਈ ਵੀ ਹੁੰਦਾ ਨਹੀਂ ਪੂਰਾ ਨਹੀਂ ਹੁੰਦਾ ਹੈ ਪੰਜਾਬ ਦਾ ਕੋਈ ਵੀ ਜਿਹੜਾ ਵਿਆਹ ਸ਼ਾਦੀ ਹੁੰਦੀ ਭੰਗੜੇ ਬਗੈਰ ਕੋਈ ਪੂਰਾ ਨਹੀਂ ਹੁੰਦਾ ਹੈ ਧੰਨਵਾਦ